ਹਾਂ ਕਿੱਦਾਂ ਆਪਾਂ ਮੰਨਦੇ ਹਾਂ ਕਿ ਪਿੰਡ ਵੀ ਵਧੀਆ ਵਾ ਸ਼ਹਿਰ ਵੀ ਵਧੀਆ ਵਾ ਪਰ ਮੈਨੂੰ ਜ਼ਿਆਦਾ ਪਿੰਡ ਰਹਿਣਾ ਵਧੀਆ ਲੱਗਦਾ ਕਿਉਂਕਿ ਪਿੰਡ ਦਾ ਜਿਹੜਾ ਵਿਊ ਹੁੰਦਾ ਉਹ ਬੜਾ ਵਧੀਆ ਹੁੰਦਾ ਫੋਟੋ ਫੋਟੋਸ਼ੂਟ ਹੋ ਜਾਂਦਾ ਉੱਥੇ ਬਹੁਤ ਵਧੀਆ ਅਤੇ ਨਾਲੇ ਪਿੰਡ ਦਾ ਵਾਤਾਵਰਨ ਬਹੁਤ ਵਧੀਆ ਹੁੰਦਾ ਉੱਥੋਂ ਦਾ ਖਾਣਾ ਪੀਣਾ ਵਾ ਸਹਿਣਾ ਰਹਿਣਾ ਸਹਿਣਾ ਬਹੁਤ ਵਧੀਆ ਹੁੰਦਾ ਵਾ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਆ ਉਹ ਬਹੁਤ ਹੀ ਜ਼ਿਆਦਾ ਤੰਦਰੁਸਤ ਹੁੰਦੇ ਆ ਅਤੇ ਉਹਨਾਂ ਦਾ ਜਿਹੜਾ ਭਾਵਨਾਵਾਂ ਬਹੁਤ ਹੁੰਦੀਆਂ ਵਾ ਉਹਨਾਂ ਦਾ ਕਿੱਦਾਂ ਨਿੱਕੀ ਨਿੱਕੀ ਗੱਲ 'ਤੇ ਉਹ ਰੁੱਸ ਜਾਂਦੇ ਨਿੱਕੀ ਨਿੱਕੀ ਗੱਲ 'ਤੇ ਉਹ ਹੱਸਣ ਲੱਗ ਪੈਂਦੇ ਆ ਆਪਣੇ ਪੰਜਾਬੀ ਕਿਹੜੇ ਹੁੰਦੇ ਆ ਬਹੁਤ ਤੁਹਾਨੂੰ ਪਤਾ ਪਿੰਡਾਂ 'ਚ ਲ ਜ਼ਿਆਦਾਤਰ ਲੋਕ ਪਿੰਡਾਂ 'ਚ ਉੱਠ ਕੇ ਸ਼ਹਿਰ 'ਚ ਆਈ ਜਾਂਦੇ ਪਰ ਪਿੰਡ ਦਾ ਵਿਊ ਬਹੁਤ ਵਧੀਆ ਹੁੰਦਾ ਵਾ ਕਿਹੜੇ ਪਿੰਡਾਂ 'ਚ ਲੋਕ ਰਹਿੰਦੇ ਆ ਉਹ ਅੱਜ ਵੀ ਤੁਸੀਂ ਵੇਖੋਗੇ ਕਿ ਕਿੱਦਾਂ ਅੱਸੀ ਸਾਲ ਦੇ ਲੋਕ ਆ ਉਹ ਬਹੁਤ ਹੀ ਹੈਲਦੀ ਆ ਅਤੇ ਆਪਣੇ ਕਿਹੜੇ ਸ਼ਹਿਰਾਂ 'ਚ ਰਹਿੰਦੇ ਆ ਉਹ ਆਪਣੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਉਹਨਾਂ ਦਾ ਵੀ ਬਹੁਤ ਘੱਟ ਹੁੰਦਾ ਵਾ ਅਤੇ ਮੈਂ ਵੀ ਜ਼ਿਆਦਾਤਰ ਪਿੰਡ 'ਚ ਹੀ ਰਹਿੰਦਾ ਮੈਂ ਹੁਣੇ ਹਫਤਾ ਕੁ ਪਹਿਲਾਂ ਪਿੰਡ ਹੋ ਕੇ ਆਇਆ ਪਿੰਡ 'ਚ ਬਹੁਤ ਹੀ ਮਜ਼ਾ ਆਉਂਦਾ ਵਾ ਪਿੰਡ 'ਚ ਮੇਰੇ ਮਾਮਾ ਮਾਮੀ ਰਹਿੰਦੇ ਆ ਮੈਂ ਉਹਨਾਂ ਦੇ ਕੋਲ ਹੀ ਰਹਿੰਦਾ ਹੁੰਦਾ ਮੇਰੇ ਕਿਹੜੇ ਮਾਮੇ ਦਾ ਮੁੰਡਾ ਉਹਦੇ ਨਾਲ ਪੈਲੀਆਂ 'ਚ ਚਲ ਜਾਣਾ ਉੱਥੇ ਜਾ ਕੇ ਘੁੰਮੀ ਫਿਰੀ ਜਾਣਾ ਫੋਟੋ ਸ਼ੂਟ ਕਰ ਲਿਆ ਜਾਂ ਕਿੱਦਾਂ ਹੋਰ ਘੁੰਮ ਲਿਆ ਅਤੇ ਆਪਣਾ ਖੇ ਖੇਡ ਲਿਆ ਅਤੇ ਉੱਥੇ ਬਹੁਤ ਸਾਰੇ ਦੋਸਤ ਆ ਆਪਣੇ ਅਤੇ ਮੱਝਾਂ ਗਾਵਾਂ ਛੱਪੜ ਕਈ ਲੋਕ ਪਹਿਲਾਂ ਮੰਨਦੇ ਆ ਮੇਰੇ ਮਾਮਾ ਦੱਸਦਾ ਹੁੰਦਾ ਕਿ ਛੱਪੜ 'ਚ ਅਸੀਂ ਨਹਾਉਂਦੇ ਰਹੇ ਆ ਪਰ ਹੁਣ ਅੱਜ ਕੱਲ੍ਹ ਛੱਪੜ ਬੜੇ ਗੰਦੇ ਆ ਪਰ ਆਪਾਂ ਨੂੰ ਸਾਫ ਸਫਾਈ ਕਰਨੀ ਚਾਹੀਦੀ ਛੱਪੜਾਂ ਦੀ ਵੀ ਅਤੇ ਪਿੰਡਾਂ 'ਚ ਵੀ ਰਹਿਣਾ ਚਾਹੀਦਾ ਜਿਹੜਾ ਪਿੰਡ ਦਾ ਵਾਤਾਵਰਨ ਹੁੰਦਾ ਉਹ ਆਪਣੀ ਸਿਹਤ ਲਈ ਵੀ ਵਧੀਆ ਹੁੰਦਾ ਵਾ ਅਤੇ ਆਪਣੇ ਕਿਹੜੇ ਲੋਕ ਆ ਉਹ ਤਾਂ ਹੁਣ ਕਿਹੜੇ ਪੁਰਾਣੇ ਬਜ਼ੁਰਗ ਆ ਉਹ ਪਿੰਡਾਂ 'ਚ ਰਹਿ ਕੇ ਖੁਸ਼ ਆ ਉਹ ਸ਼ਹਿਰ 'ਚ ਆ ਕੇ ਨਹੀਂ ਖੁਸ਼ ਹੁੰਦੇ ਤਾਂ ਕਰਕੇ ਉਹ ਆਪਣੇ ਕਈ ਰਿਸ਼ਤੇਦਾਰ ਤੋਂ ਵੀ ਨਹੀਂ ਜਾਂਦੇ ਉਹ ਸ਼ੁਰੂ ਤੋਂ ਪਿੰਡ 'ਚ ਰਹੇ ਕਿਹੜੇ ਪਿੰਡਾਂ 'ਚ ਰਹਿੰਦੇ ਆ ਉਹ ਤੁਹਾਨੂੰ ਪਤਾ ਕੀ ਖਾਣ ਪੀਣ ਵੱਲੋਂ ਖੁੱਲ੍ਹੇ ਹੁੰਦੇ ਆ ਅਤੇ ਬਾਕੀ ਰਹੀ ਗੱਲ ਪਿੰਡਾਂ ਦੀ